ਅੱਜ ਦਾ ਦੌਰ ਇੰਟਰਨੈੱਟ ਦਾ ਦੌਰ ਹੈ ਜੀ ਸਾਡੇ ਸਮਿਆਂ ਦੇ ਵਿੱਚ ਇੰਟਰਨੈੱਟ ਦਾ ਦੌਰ ਨਹੀਂ ਹੋਇਆ ਕਰਦਾ ਸੀਗਾ ਨਾ ਹੀ ਲੈਪਟੋਪ ਅਤੇ ਨਾ ਹੀ ਫ਼ੋਨ ਹੋਇਆ ਕਰਦੇ ਹੁੰਦੇ ਸੀ ਜੀ ਤਾਂ ਜੋ ਹੈ ਮੈਂ ਹੱਥ ਨਾਲ਼ ਲਿਖਣਾ ਜ਼ਿਆਦਾ ਪਸੰਦ ਕਰਦਾ ਹਾਂ ਅਤੇ ਮੈਂ ਜ਼ਰੂਰ ਇੰਨਾ ਕੁ ਕਹਾਂਗਾ ਕਿ ਇਸ ਮੋਬਾਇਲ ਦੇ ਇਸ ਆਧੁਨਿਕ ਯੁੱਗ ਦੇ ਵਿੱਚ ਮੈਂ ਮੋਬਾਇਲ 'ਤੇ ਜ਼ਰੂਰ ਕੁਛ ਟਾਈਪ ਕਰਨਾ ਹੁੰਦਾ ਕੋਈ ਮੈਸੇਜ ਟਾਈਪ ਕਰਨੇ ਹੁੰਦੇ ਹਨ ਉਹ ਮੈਂ ਜ਼ਰੂਰ ਪਸੰਦ ਕਰ ਲੈਣਾ ਸੰਭਵ ਸਮਝਦਾ ਪਰ ਮੈਂ ਆਪਣੇ ਹੱਥੀਂ ਲਿਖਣਾ ਜ਼ਿਆਦਾ ਬਿਹਤਰ ਪਸੰਦ ਕਰਦਾ ਹਾਂ